ਪੇਂਡੂ ਖੇਤਰਾਂ ਵਿੱਚ ਜੋ ਲੋਕ ਰਹਿੰਦੇ ਹਨ ਉਹਨਾਂ ਦਾ ਜੋ ਮੁੱਖ ਧੰਦਾ ਹੈ ਉਹ ਖੇਤੀਬਾੜੀ ਹੈ ਖੇਤੀ ਵਿੱਚ ਉਹਨਾਂ ਨੂੰ ਬਹੁਤ ਹੀ ਮੁਸ਼ਕਿਲਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਵੱਡੀ ਚੁਣੌਤੀ ਜੋ ਉਹਨਾਂ ਦੀ ਜ਼ਿੰਦਗੀ ਵਿਚ ਆਉਂਦੀ ਹੈ ਉਹ ਵਿੱਤੀ ਚੁਣੌਤੀ ਹੈ ਭਾਵ ਪੈਸੇ ਦੀ ਚੁਣੌਤੀ ਹੈ ਕਿਉਂਕਿ ਸਾਡੇ ਦੇਸ਼ ਦਾ ਜੋ ਕਿਸਾਨ ਹੈ ਉਹ ਬਹੁਤ ਹੀ ਗਰੀਬ ਹੈ ਉਸਨੂੰ ਆਪਣੀ ਫ ਫਸਲ ਬੀਜਣ ਤੋਂ ਵੱਢਣ ਤੱਕ ਵਿੱਤੀ ਸਹਾਇਤਾ ਦੀ ਲੋੜ ਹੈ ਤਾਂ ਜੋ ਉਹ ਵਧੀਆ ਬੀਜ ਕੀਟਨਾਸ਼ਕ ਦਵਾਈਆਂ ਅਤੇ ਹੋਰ ਜੋ ਘਰੇਲੂ ਜਾਂ ਖੇਤੀ ਸੰਬੰਧੀ ਸਾ ਜੋ ਸਮਾਨ ਹੈ ਉਹ ਖਰੀਦ ਸਕੇ ਇਹ ਵਿੱਤੀ ਸਹਾਇਤਾ ਜੋ ਕਿਸਾਨਾਂ ਨੂੰ ਚਾਹੀਦੀ ਹੈ ਉਹ ਕਰਜਿਆਂ ਦੇ ਰੂਪ ਵਿੱਚ ਸਹਿਕਾਰੀ ਸਭਾਵਾਂ ਦੁਆਰਾ ਦਿੱਤੀ ਜਾਂਦੀ ਹੈ ਅਤੇ ਕੁਝ ਲੋਕ ਆੜ੍ਹਤੀਆਂ ਪਾਸੋਂ ਵੀ ਵਿਆਜ 'ਤੇ ਕਰਜ਼ਾ ਲੈਂਦੇ ਹਨ ਪਰ ਕਈ ਵਾਰ ਸਮੇਂ ਸਿਰ ਕਰਜ਼ਾ ਨਾ ਮੌੜਨ ਕਰਕੇ ਉਹਨਾਂ ਦੀ ਜ਼ਮੀਨ ਜਾਇਦਾਦ ਦੀ ਕੁਰਕੀ ਵੀ ਹੋ ਜਾਂਦੀ ਹੈ ਇਸ ਤੋਂ ਬਿਨਾਂ ਖੇਤੀ ਜ਼ਿਆਦਾਤਰ ਮੌਸਮ ਅਤੇ ਵਾਤਾਵਰਨ ਉੱਪਰ ਬਹੁਤ ਨਿਰਭਰ ਕਰਦੀ ਹੈ ਜਿਵੇਂ ਕਿ ਬੇਮੌਸਮੀ ਵਰਖਾ ਹੋਣਾ ਹਨੇਰੀ ਤੂਫਾਨ ਦਾ ਆਉਣਾ ਅਤੇ ਹੋਰ ਕੁਦਰਤੀ ਜਿਵੇਂ ਆਫਤਾਂ ਨੇ ਉਹ ਬਹੁਤ ਮੁਸ਼ਕਿਲਾਂ ਪੈਦਾ ਕਰਦੀਆਂ ਹਨ ਕਈ ਵਾਰ ਉਹਨਾਂ ਦਾ ਭਾਵ ਕਿਸਾਨਾਂ ਦਾ ਇੰਨਾਂ ਨੁਕਸਾਨ ਹੋ ਜਾਂਦਾ ਹੈ ਕਿ ਕਈ ਕਿਸਾਨਾਂ ਨੇ ਤਾਂ ਖੁਦਕੁਸ਼ੀਆਂ ਵੀ ਕੀਤੀਆਂ ਨੇ ਜਿਹਨਾਂ ਦਾ ਡਾਟਾ ਇੰਟਰਨੈਟ 'ਤੇ ਆਪਾਂ ਦੇਖ ਸਕਦੇ ਹਾਂ ਇਸ ਤੋਂ ਬਿਨਾਂ ਕਿਸਾਨਾਂ ਨੂੰ ਸਮੇਂ ਸਮੇਂ ਸਿਰ ਤਕਨੀਕੀ ਸਹਾਇਤਾ ਵੀ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਤਕਨੀਕੀ ਸਹਾਇਤਾ ਵਿੱਚ ਉਹਨਾਂ ਨੂੰ ਸਮੇਂ ਸਮੇਂ ਸਿਰ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਕੱਲ੍ਹ ਦੇਖਦੇ ਹਾਂ ਕਿ ਸਰਕਾਰ ਵੱਲੋਂ ਅਜਿਹੀਆਂ ਐਪ ਨੇ ਉਹ ਚਲਾਈਆਂ ਗਈਆਂ ਨੇ ਜਿਹਨਾਂ ਦੇ ਮੱਧਿਅਮ ਰਾਹੀਂ ਅਸੀਂ ਮੌਸਮ ਦੇ ਸੰਬੰਧੀ ਮੈਸੇਜ ਦੇ ਰੂਪ ਵਿੱਚ ਅਸੀਂ ਮੈਸੇਜ ਪ੍ਰਾਪਤ ਕਰਦੇ ਹਾਂ ਇਸ ਤੋਂ ਬਿਨਾਂ ਟੈਲੀਵਿਜ਼ਨ ਦੇ ਮੱਧਿਅਮ ਰਾਹੀਂ ਵੀ ਵਾਤਾਵਰਨ ਸੰਬੰਧੀ ਜੋ ਜਾਣਕਾਰੀ ਹੈ ਉਹ ਸਾਨੂੰ ਮਿਲਦੀ ਹੈ ਇਸ ਤੋਂ ਬਿਨਾਂ ਸਰਕਾਰ ਵੱਲੋਂ ਛੋਟੇ ਪੱਧਰ ਦੇ ਕਿਸਾਨਾਂ ਨੂੰ ਵੱਖ ਵੱਖ ਧੰਦਿਆਂ ਸੰਬੰਧੀ ਵੀ ਸਿਖਲਾਈ ਦਿੱਤੀ ਜਾਂਦੀ ਹੈ ਜਿਵੇਂ ਕਿ ਮੱਛੀ ਪਾਲਣਾ ਪੋਲਟਰੀ ਸੰਬੰਧੀ ਖੁੰਭਾਂ ਦੀ ਖੇਤੀ ਸੰਬੰਧੀ ਅਤੇ ਪਸ਼ੂਆਂ ਦੇ ਪਾਲਣ ਸੰਬੰਧੀ ਵੀ ਸਮੇਂ ਸਮੇਂ ਸਿਰ ਜਾਣਕਾਰੀ ਦਿੱਤੀ ਜਾਂਦੀ ਹੈ ਧੰਨਵਾਦ